ਮੈਂ ਰਾਜ ਕੁਮਾਰ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਤਕਨੀਕੀ ਸੁਧਾਰ ਬਾਰੇ ਦੱਸਣਾ ਚਾਹੁੰਦਾ ਹਾਂ ਜਿਵੇਂ ਕਿ ਸਾਡੇ ਇਲਾਕੇ ਵਿੱਚ ਨੈਟਵਰਕਿੰਗ ਦੀ ਪ੍ਰੋਬਲਮ ਹੈ ਜਿਵੇਂ ਕਈ ਥਾਵਾਂ 'ਤੇ ਹਾਲੇ ਟੀ ਵੀ ਵੀ ਨਹੀਂ ਪੁੱਜਿਆ ਨਾ ਟੀ ਵੀ ਦੀ ਸੁਵਿਧਾ ਹੈ ਨਾ ਸੁਵਿਸਾ ਸੁਵਿਧਾ ਸੈਂਟਰ ਹਨ ਅਤੇ ਨਾ ਹੀ ਉੱਥੇ ਦੇ ਲੋਕਾਂ ਨੂੰ ਹਾਲੇ ਤੱਕ ਇਹ ਨਾ ਪਤਾ ਹੈ ਕਿ ਐਲ ਈ ਡੀ ਵਗੈਰਾ ਕੀ ਹੁੰਦੇ ਹਨ ਇਸ ਤਰ੍ਹਾਂ ਜਿਵੇਂ ਕਿ ਸਾਡੇ ਪੰਜਾਬ ਵਿੱਚ ਕਾਫੀ ਪਰੇਸ਼ਾਨੀਆਂ ਹਨ ਜਿਵੇਂ ਕਿ ਨੈਟਵਰਕਿੰਗ ਦੀ ਪ੍ਰੋਬਲਮ ਅਤੇ ਆਵਾਜਾਈ ਦੀ ਘਾਟ ਅਤੇ ਟੈਕਨੋਲਜੀ ਬਾਰੇ ਜੇਕਰ ਗੱਲ ਕੀਤੀ ਜਾਵੇ ਤਾਂ ਸਾਡੇ ਸ਼੍ਰੀਨਗਰ ਵਿੱਚ ਇੱਕ ਸਭ ਤੋਂ ਵੱਡਾ ਪੁਲ ਬਣਿਆ ਹੈ ਇਹ ਟੈਕਨੋਲੋਜੀ ਦੀ ਹੀ ਹੈ ਕਰਾਮਾਤ ਹੈ